ਮੈਨੂੰ ਲਿਖਣ ਦਾ ਸ਼ੌਂਕ ਆਪਣੇ ਕਾਲਜ ਦੇ ਦਿਨਾਂ ਵਿੱਚ ਹੋਇਆ ਸੀ ਪਹਿਲਾਂ ਤਾਂ ਮੈਂ ਲਿਖਣ ਲਈ ਪੈਨ ਅਤੇ ਕਾਗਜ਼ ਦੀ ਵਰਤੋਂ ਹੀ ਕਰਦੀ ਸੀ ਮੈਨੂੰ ਇਹ ਬਹੁਤ ਆਸਾਨ ਲੱਗਦਾ ਸੀ ਪਰ ਉਸ ਤੋਂ ਬਾਅਦ ਜਦੋਂ ਦਾ ਮੈਂ ਮੋਬਾਈਲ ਵਰਤਣ ਲੱਗੀ ਮੈਨੇ ਲਿਖਣ ਲਈ ਜ਼ਿਆਦਾਤਰ ਮੋਬਾਇਲ ਦੀ ਹੀ ਵਰਤੋਂ ਕੀਤੀ ਪਰ ਇਹ ਵੀ ਗੱਲ ਸੱਚ ਹੈ ਕਿ ਜੋ ਮਜ਼ਾ ਪੈਨ ਅਤੇ ਕਾਗਜ਼ਾਂ ਲਿਖਣ 'ਚ ਆਉਂਦਾ ਹੈ ਉਹ ਮੋਬਾਈਲ 'ਤੇ ਨਹੀਂ ਆਉਂਦਾ ਪਰ ਅੱਜ ਮੈਂ ਜ਼ਿਆਦਾਤਰ ਮੋਬਾਇਲ ਹੀ ਵਰਤੀ ਵਰਤਦੀ ਹਾਂ ਕਈ ਵਾ ਕਈ ਸਾਲ ਹੋ ਗਏ ਮੈਨੂੰ ਹੁਣ ਲਿਖਦੇ ਨੂੰ ਇਸ ਲਈ ਬਹੁਤ ਮੇਰੀ ਲਿਖਾਵਟ ਵਿੱਚ ਬਹੁਤ ਹੀ ਬਦਲਾਅ ਆਇਆ ਹੈ ਪਹਿਲਾਂ ਮੈਂ ਬਹੁਤ ਹੀ ਬੇਸਿਕ ਲਿਖਿਆ ਕਰਦੀ ਸੀ ਪਰ ਜਦੋਂ ਤੋਂ ਮੈਨੇ ਹੋਰ ਦੂਜੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਉਸ ਨਾਲ ਮੇਰੇ ਲਿਖਣ ਵਿੱਚ ਬਹੁਤ ਬਦਲਾਅ ਆਇਆ ਮੈਨੇ ਬਹੁਤ ਚੰਗੀ ਤਰ੍ਹਾਂ ਲਿਖਣਾ ਸ਼ੁਰੂ ਕੀਤਾ ਅਤੇ ਉਸਨੂੰ ਇੱਕ ਤਰਤੀਬ ਵਿੱਚ ਵੀ ਲਿਖਣਾ ਸ਼ੁਰੂ ਕੀਤਾ ਮੋਬਾਇਲ 'ਤੇ ਇਹ ਹੀ ਸੌਖਾ ਹੈ ਕਿ ਤੁਸੀਂ ਕਿਸੇ ਵੀ ਲਿਖਾਵਟ ਨੂੰ ਤਰਤੀਬ ਵਿੱਚ ਕਰ ਸਕਦੇ ਹੋ ਅਤੇ ਇਸ ਵਿੱਚ ਇਜ਼ਲੀ ਤੁਸੀਂ ਕਿਸੇ ਵੀ ਚੀਜ਼ ਨੂੰ ਸੇਵ ਕਰ ਸਕਦੇ ਹੋ ਤਾਂ ਕਿ ਜੋ ਇਸ ਨੂੰ ਕਦੇ ਵੀ ਦੇਖ ਸਕੋ ਕਾਗਜ਼ ਅਤੇ ਪੈਨ ਨਾਲ ਤੁਹਾਨੂੰ ਵਾਰ ਵਾਰ ਮਿਟਾਉਣਾ ਔਖਾ ਹੁੰਦਾ ਸੀ ਪਰ ਮੋਬਾਈਲ 'ਤੇ ਇਹ ਕੰਮ ਬਹੁਤ ਆਸਾਨ ਹੈ ਤੁਸੀਂ ਆਸਾਨੀ ਨਾਲ ਆਪਣੇ ਲਿਖੇ ਹੋਏ ਨੂੰ ਮਿਟਾ ਕੇ ਉਸਦੀ ਜਗ੍ਹਾ ਕੁਝ ਵੀ ਹੋਰ ਲਿਖ ਸਕਦੇ ਹੋ ਇਸ ਲਈ ਹੁਣ ਮੈਂ ਮੋਬਾਈਲ ਦਾ ਇਸਤੇਮਾਲ ਹੀ ਜ਼ਿਆਦਾ ਕਰਨਾ ਚਾਹੁੰਦੀ ਹਾਂ